ਸਤਿ ਸ਼੍ਰੀ ਅਕਾਲ ਜੀ ਨਿਵਾਸ ਚਾਵਲਾ ਏਜੰਸੀ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਮੇਰੇ ਦੋਸਤ ਨੇ ਤੁਹਾਡਾ ਨੰਬਰ ਦਿੱਤਾ ਸੀ ਅਸੀਂ ਗੱਡੀ ਬੁੱਕ ਕਰਾਉਣੀ ਸੀ ਹਾਂਜੀ ਕਸ਼ਮੀਰ ਜਾਣ ਵਾਸਤੇ ਅਸੀਂ ਚਾਰ ਤੋਂ ਪੰਜ ਦੋਸਤ ਹਾਂ ਹਾਂਜੀ ਹਾਂ ਹਾਂ ਅਸੀਂ ਖੁਦ ਹੀ ਡਰਾਈਵ ਕਰਾਂਗੇ ਹਾਂ ਹਾਂ ਪੁੱਛਣਾ ਸੀ ਕਿ ਤੁਸੀਂ ਪ੍ਰਤੀ ਕਿਲੋਮੀਟਰ ਕੀ ਲਓਗੇ ਪੱਚੀ ਕੁ ਰੁਪਏ ਨਹੀਂ ਪੱਚੀ ਤਾਂ ਜ਼ਿਆਦਾ ਥੋੜ੍ਹੇ ਤਾਂ ਘੱਟ ਕਰੋ ਹਾਂ ਦੋਸਤ ਨੇ ਤੁਹਾਨੂੰ ਰੈਫਰ ਕੀਤਾ ਅਤੇ ਫਿਰ ਤਾਂ ਥੋੜ੍ਹੇ ਘੱਟ ਲੈਣੇ ਚਾਹੀਦੇ ਤੁਹਾਨੂੰ ਹਾਂਜੀ ਵੈਸੇ ਕਿਹੜੀ ਗੱਡੀ ਤੁਸੀਂ ਸਾਨੂੰ ਪ੍ਰੋਵਾਈਡ ਕਰੋਗੇ ਪੈਟਰੋਲ ਡੀਜ਼ਲ ਜਾਂ ਸੀ ਐੱਨ ਜੀ ਕਿਹੜੀ ਸਹੀ ਰਹੇਗੀ ਸੀ ਐੱਨ ਜੀ ਵਾਲੀ ਸੀ ਐੱਨ ਜੀ ਦੇ ਸਟੇਸ਼ਨਜ਼ ਅਵੇਲੇਬਲ ਹੋਣਗੇ ਉੱਥੇ ਰਸਤੇ ਦੇ ਵਿੱਚ ਠੀਕ ਹੈ ਕਾਗਜ ਵਗੈਰਾ ਪੂਰੇ ਹੋਣਗੇ ਗੱਡੀ ਦੇ ਫਸਟ ਏਡ ਵਾਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਸਾਨੂੰ ਇਹਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦੇ ਦੇਣਾ ਗੱਡੀ ਛੋਟੀ ਸਹੀ ਰਹੇਗੀ ਜਾਂ ਵੱਡੀ ਹਾਂਜੀ ਇਨਸ਼ੋਰੈਂਸ ਵਗੈਰਾ ਹੋਈ ਹੋਵੇ ਗੱਡੀ ਦੀ ਰਸਤੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਹਾਂਜੀ ਹਾਂ ਕੈਰੀਅਰ ਵੀ ਨਾ ਉੱਪਰ ਹੀ ਲੱਗਾ ਹੋਵੇ ਗੱਡੀ ਦੇ ਉੱਪਰ ਤਾਂ ਕਿ ਸਾਰਾ ਸਮਾਨ ਉੱਪਰ ਆਰਾਮ ਨਾਲ ਫਿੱਟ ਹੋ ਜਾਏ ਅਤੇ ਅਸੀਂ ਕੰਫਰਟੇਬਲੀ ਅੰਦਰ ਗੱਡੀ ਦੇ ਬੈਠ ਸਕੀਏ ਹਾਂਜੀ ਚਲੋ ਠੀਕ ਹੈ ਅਸੀਂ ਅ ਡਿਸਾਈਡ ਕਰ ਲੈਂਦੇ ਹਾਂ ਕਿ ਕਿਵੇਂ ਕਰਨਾ ਵਾ ਤੁਸੀਂ ਪਲੀਜ਼ ਪੈਸੇ ਜੈਨੂਅਨ ਜਿਹੇ ਲੈਣਾ ਬਿਲਕੁਲ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ